ਮੈਂ ਦਿਕਸ਼ਾ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕਿਰ ਦਰਦ ਦੇ ਇਲਾਜ ਲਈ ਪਿੰਡਾਂ ਵਿੱਚ ਘਰੇਲੂ ਨੁਸਖੇ ਕੀ ਹੁੰਦੇ ਹਨ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਡਾਕਟਰਾਂ ਕੋਲ ਜਾਂਦੇ ਹਨ ਅਤੇ ਜੇ ਸਾਨੂੰ ਕਿਤੇ ਥੋਜ਼ਿ ਜਿਹੀ ਵੀ ਦਰਦ ਹੁੰਦੀ ਹੈ ਤਾਂ ਅਸੀਂ ਦਵਾਈ ਲੈ ਲੈਂਦੇ ਹਾਂ ਪਰ ਕੀ ਉਹ ਦਵਾਈ ਸਾਡੇ ਸਰੀਰ ਲਈ ਚੰਗੀ ਹੈ ਜਾਂ ਮਾੜੀ ਹੈ ਅਸੀਂ ਬਿਨਾਂ ਸੋਚੇ ਸਮਝੇ ਹੀ ਉਸਨੂੰ ਖਾ ਲੈਂਦੇ ਹਾਂ ਪਰ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਲੋਕ ਡਾਕਟਰਾਂ ਕੋਲ ਨਾ ਜਾ ਕੇ ਪਹਿਲੇ ਸਮੇਂ ਵਿੱਚ ਵੈਦ ਹੁੰਦੇ ਸਨ ਤਾਂ ਵੈਦ ਕੀ ਕਰਦੇ ਸੀ ਜੇ ਸਾਨੂੰ ਕਿਸੇ ਚੀਜ਼ ਦੀ ਤਕਲੀਫ ਹੈ ਸਿਰ ਦਰਦ ਹੈ ਜਾਂ ਫਿਰ ਕਿਤੇ ਹੋਰ ਦਰਦ ਹੈ ਤਾਂ ਉਹ ਸਾਨੂੰ ਜੜ੍ਹੀ ਬੂਟੀਆਂ ਦਾ ਲੇਪ ਬਣਾ ਦਿੰਦੇ ਸਨ ਜਾਂ ਫਿਰ ਕੋਈ ਐਸਾ ਕਾੜਾ ਬਣਾ ਕੇ ਦਿੰਦੇ ਸਨ ਜਿਹਦੇ ਨਾਲ ਸਾਨੂੰ ਫਰਕ ਪੈ ਜਾਂਦਾ ਸੀ ਔਰ ਇਸ ਤੋਂ ਇਲਾਵਾ ਜਿਹੜੇ ਘਰੇਲੂ ਨੁਸਖੇ ਸਨ ਉਹ ਸੀ ਇਹ ਸਨ ਕਿ ਜੇ ਸਾਡੇ ਸਿਰ ਦਰਦ ਹੈ ਤਾਂ ਅਸੀਂ ਸਿਰ ਦੀ ਮਾਲਿਸ਼ ਕਰ ਲੈਂਦੇ ਸੀ ਜਾਂ ਫਿਰ ਜਿਹੜੀਆਂ ਮਾਤਾ ਹੁੰਦੀਆਂ ਹਨ ਸਾਡੀਆਂ ਉਹ ਤੇਲ ਦੇ ਵਿੱਚ ਪਾਣੀ ਪਾ ਕੇ ਉਹਦੀ ਸਿਰ ਦੇ ਵਿੱਚ ਚੰਗੀ ਤਰ੍ਹਾਂ ਚਾਸ ਕਰਦੇ ਸਨ ਜਾਂ ਫਿਰ ਉਹ ਸਾਨੂੰ ਕਈ ਵਾਰ ਨਿੰਮ ਦੇ ਪੱਤੇ ਗਿੱਲੇ ਕਰਕੇ ਸਿਰ 'ਤੇ ਰੱਖਦੇ ਸਨ ਜਿਹਦੇ ਨਾਲ ਕਿ ਸਾਡੇ ਸ਼ ਸਿਰ ਨੂੰ ਥੋੜ੍ਹੀ ਠੰਡਕ ਮਿਲਦੀ ਸੀ ਅਤੇ ਸਾਡੇ ਜਿਹੜਾ ਸਿਰ ਦਰਦ ਹੈ ਉਹ ਠੀਕ ਹੋਣ ਲੱਗ ਪੈਂਦਾ ਸੀ ਪਰ ਅੱਜ ਦੇ ਟਾਈਮ 'ਤੇ ਇਹ ਸਭ ਚੀਜ਼ਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਧੰਨਵਾਦ